ਜੇਕਰ ਮੈਂ ਨਵਾਂ ਸਮਾਰਟ ਫੋਨ ਖਰੀਦਣਾ ਹੋਵੇ ਪਹਿਲੀ ਗੱਲ ਤਾਂ ਮੈਨੂੰ ਇਹ ਹੋਣਾ ਚਾਹੀਦਾ ਕਿ ਉਹ ਫਾਈਵ ਜੀ ਹੋਣਾ ਚਾਹੀਦਾ ਦੂਸਰੀ ਗੱਲ ਇਹ ਕਿ ਮਤਲਬ ਕਿ ਉਹਦੇ 'ਚ ਸਾਰੇ ਨਿਊ ਐਪਸ ਹੋਣੇ ਚਾਹੀਦੇ ਹਨ ਜਿਨ੍ਹਾਂ ਨਾਲ ਮੈਂ ਹਰ ਇੱਕ ਚੀਜ਼ ਨੂੰ ਸਰਚ ਕਰ ਸਕਾਂ ਈਜੀਲੀ ਮੈਨੂੰ ਇਜੀਲੀ ਸਟੱਡੀ ਕਰ ਸਕਾਂ ਅਤੇ ਮੈਂ ਜੇ ਆਨਲਾਈਨ ਜਾਂ ਆਫਲਾਈਨ ਮਾਰਕੀਟ ਦੀ ਗੱਲ ਕਰਾਂ ਤਾਂ ਮੈਂ ਹਮੇਸ਼ਾ ਆਫਲਾਈਨ ਮਾਰਕੀਟ ਹੀ ਯੂਜ ਕਰੂੰਗੀ ਕਿਉਂਕਿ ਆਨਲਾਈਨ ਮਾਰਕੀਟ ਦੇ ਵਿੱਚ ਬਹੁਤ ਸਾਰੇ ਜਿਹੜੇ ਇਹੋ ਜਿਹੇ ਫਰੋਡ ਕੇਸ ਆਉਂਦੇ ਹਨ ਜਿਹੜੇ ਕੀ ਕਰਦੇ ਹਨ ਸਾਨੂੰ ਮਤਲਬ ਕਿ ਲੋਸ ਕਰਦੇ ਹਨ ਇਸ ਕਰਕੇ ਹਮੇਸ਼ਾ ਆਫਲਾਈਨ ਦੇ ਵਿੱਚ ਇਹ ਹੈ ਕਿ ਅਸੀਂ ਖੁਦ ਜਾ ਕੇ ਉਹਨਾਂ ਨੂੰ ਦੇਖਦੇ ਹਾਂ ਖੁਦ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਖੁਦ ਫੋਨ ਖਰੀਦ ਫੋਨ ਵੀ ਖਰੀਦ ਸਕਦੇ ਹਾਂ ਅਤੇ ਉਹਦੇ ਨਾਲ ਅਸੀਂ ਦੇਖ ਵੀ ਸਕਦੇ ਹਾਂ ਉਹਨਾਂ ਨੂੰ ਮਤਲਬ ਕਿ ਈਜ਼ੀ ਐਕਸਚੇਂਜ ਵੀ ਕਰ ਸਕਦੇ ਹਾਂ ਆਨਲਾਈਨ ਦੇ ਵਿੱਚ ਐਕਸਚੇਂਜ ਆਫਰ ਦਾ ਵੀ ਥੋੜ੍ਹਾ ਰਿਸਕ ਹੁੰਦਾ ਠੀਕ ਹੈ ਕਿ ਪਤਾ ਨਹੀਂ ਕਿ ਉਹ ਚੀਜ਼ ਅਗਲੀ ਵਾਰ ਸਹੀ ਮਿਲੇਗੀ ਕਿ ਨਹੀਂ ਆਫਲਾਈਨ ਦਾ ਇਹ ਕੀ ਸਾਨੂੰ ਉਸ ਚੀਜ਼ ਨਾਲ ਵਧੀਆ ਬੈਟਰ ਮਿਲ ਸਕਦੀ ਹੈ